ਸ਼ੌਂਕ ਵਜੋਂ ਫੋਟੋਗ੍ਰਾਫੀ ਜਾਰੀ ਰੱਖਣ ਲਈ ਮੇਰੀ ਪ੍ਰੇਰਨਾ ਮੇਰੀ ਪ੍ਰੇਰਨਾ ਐਕਚੁਲੀ ਬਸ ਮੈਨੂੰ ਤਾਂ ਨੋਰਮਲ ਠੀਕ ਲੱਗਦਾ ਕਿ ਹਾਂ ਫੋਟੋਗ੍ਰਾਫੀ ਕੀਤੀ ਜਾਵੇਗੀ ਤਾਂ ਕਿ ਥੋੜ੍ਹਾ ਤੁਹਾਨੂੰ ਪਤਾ ਅੱਜ ਕੱਲ੍ਹ ਜਿਹੜਾ ਆਪਣਾ ਸੂਸ ਸੋਸ਼ਲ ਐਕਟੀਵਿਟੀ ਜਾਂ ਸੋਸ਼ਲ ਪਲੈਟਫਾਰਮ ਨੇ ਉੱਤੇ ਮਨੋਰੰਜਨ ਦੇ ਲਈ ਵੈਸੇ ਥੋੜ੍ਹੀ ਬਹੁਤ ਫੋਟੋਗ੍ਰਾਫੀ ਕਰਦਾ ਐਸਾ ਕੁਛ ਹੈ ਨਹੀਂ ਖ਼ਾਸ ਕਿ ਹਾਂ ਫੋਟੋਗ੍ਰਾਫੀ ਮੈਂ ਹਰ ਹਫ਼ਤੇ ਦੇ ਵਿੱਚ ਜਾਂ ਹਰ ਦੋ ਹਰ ਦੋ ਹਫ਼ਤਿਆਂ ਦੇ ਵਿੱਚ ਇੱਕ ਅੱਧੀ ਫੋਟੋ ਤਾਂ ਇੱਕ ਵਧੀਆ ਜੀ ਪਾਉਂਦਾ ਹੀ ਪਾਉਂਦਾ ਆਪਣੇ ਇੰਸਟਾਗਰਾਮ 'ਤੇ ਜਾਂ ਫਿਰ ਆਪਣੀ ਫੇਸਬੁੱਕ 'ਤੇ ਇਸ ਤੋਂ ਇਲਾਵਾ ਤਾਂ ਮੈਂ ਹੋਰ ਕੋਈ ਇਹੋ ਜਿਹੀ ਕੋਈ ਪ੍ਰੇਰਨਾ ਤਾਂ ਮੈਨੂੰ ਕਿਤੋਂ ਨਹੀਂ ਮਿਲਦੀ ਵੀ ਹਾਂ ਕਿ ਮੈਂ ਫੋਟੋਗ੍ਰਾਫੀ ਕੀਤੀ ਪ੍ਰੇਰਨ ਕਿਸੇ ਤੋਂ ਪ੍ਰੇਰਨਾ ਲੈ ਕੇ ਕਰਦਾ ਤਾਂ ਹਾਂ ਆਪਣੇ ਦਿਲ ਖਵਾਇਸ਼ ਹੁੰਦੀ ਹੈ ਸ਼ੌਂਕ ਹੁੰਦਾ ਮੇਰੀ ਹੋਬੀ ਹੈ ਕਿ ਹਾਂ ਇੱਕ ਵਧੀਆ ਮੈਂ ਹਮੇਸ਼ਾ ਇਹ ਹੀ ਸੋਚਦਾ ਕਿ ਵਧੀਆ ਫੋਟੋ ਜਿਹਦਾ ਕਿ ਬੈਕਗਰਾਊਂਡ ਪਿੱਛੇ ਵਧੀਆ ਹੋਵੇ ਉਹ ਹੀ ਫੋਟੋ ਮੈਂ ਕਲਿੱਕ ਕਰਦਾ ਅਤੇ ਉਸ ਫੋਟੋ ਨੂੰ ਅਪਲੋਡ ਕਰਦਾ ਇਸ ਤੋਂ ਇਲਾਵਾ ਤਾਂ ਹੋਰ ਕੋਈ ਇਹੋ ਜਿਹੀ ਪ੍ਰੇਰਨਾ ਨਹੀਂ ਹੈ ਜੋ ਮੈਂ ਤੁਹਾਨੂੰ ਦੱਸ ਸਕਾਂ